ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਕਿਸੇ ਵੀ ਬੁਰੇ ਜਾਂ ਕਿਸੇ ਵੀ ਚੰਗੇ ਕੰਮ ਨੂੰ ਲੋਕਾਂ ਤੱਕ ਪਹੁੰਚਾਉਣਾ ਬਹੁਤ ਹੀ ਆਸਾਨ ਹੋ ਗਿਆ ਹੈ ਅਤੇ ਇਸ ਨੂੰ ਹੋਰ ਆਸਾਨ ਬਣਾਉਂਦੀ ਹੈ ਫੋਟੋਗ੍ਰਾਫੀ ਜੇ ਅੱਜ ਕਿਸੇ ਦੇ ਨਾਲ ਵੀ ਕੋਈ ਅਨਿਆਏ ਹੁੰਦਾ ਹੈ ਕੋਈ ਵੀ ਮਾੜਾ ਕੰਮ ਹੁੰਦਾ ਹੈ ਤਾਂ ਉਸਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਜਾਵੇ ਉਹ ਬਹੁਤ ਹੀ ਛੇਤੀ ਵਾਇਰਲ ਹੋ ਜਾਵੇਗੀ ਜਿਸ ਨਾਲ ਲੋਕਾਂ ਨੂੰ ਬਹੁਤ ਛੇਤੀ ਪਤਾ ਚੱਲ ਜਾਵੇਗਾ ਅਤੇ ਲੋਕ ਇਕੱਠੇ ਹੋ ਕੇ ਉਹ ਅਨਿਆਏ ਖਿਲਾਫ਼ ਆਵਾਜ਼ ਉਠਾਉਣਗੇ ਜੇ ਉਹ ਫੋਟੋ ਕਿਸੇ ਵੱਡੇ ਅਫ਼ਸਰ ਕੋਲ ਪਹੁੰਚ ਜਾਂਦੀ ਹੈ ਤਾਂ ਉਸ ਅਪਰਾਧੀ ਨੂੰ ਛੇਤੀ ਤੋਂ ਛੇਤੀ ਸਜ਼ਾ ਵੀ ਮਿਲ ਸਕਦੀ ਹੈ ਇਸ ਤਰ੍ਹਾਂ ਜੇ ਕੋਈ ਚੰਗਾ ਕੰਮ ਕਰਦਾ ਹੈ ਜਿਵੇਂ ਕਿਸੇ ਦੀ ਸੇਵਾ ਕਰਦਾ ਹੈ ਕਿਸੇ ਗਰੀਬ ਦੀ ਬੇਟੀ ਦਾ ਵਿਆਹ ਕਰਦਾ ਜਾਂ ਸਮੂਹਿਕ ਵਿਆਹ ਕਰਵਾਉਂਦਾ ਹੈ ਜਾਂ ਕਿਸੇ ਗਰੀਬ ਦਾ ਘਰ ਬਣਵਾਉਂਦਾ ਹੈ ਧਰਮਸ਼ਾਲਾ ਬਣਵਾਉਂਦਾ ਹੈ ਜਾਂ ਕੋਈ ਗਊਸ਼ਾਲਾ ਕੋਈ ਬਣਵਾਉਂਦਾ ਹੈ ਜਾਂ ਕੋਈ ਆਸ਼ਰਮ ਖੋਲਦਾ ਹੈ ਜੇ ਉਸਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਜਾਵੇ ਤਾਂ ਲੋਕਾਂ ਨੂੰ ਇਸ ਚੰਗੇ ਕੰਮ ਬਾਰੇ ਪਤਾ ਲੱਗੇਗਾ ਅਤੇ ਉਹਨਾਂ ਨੂੰ ਵੀ ਉਹ ਇੱਕ ਪ੍ਰੇਰਨਾ ਵਾਂਗੂ ਮਿਲਦਾ ਹੈ ਇਸ ਦਾ ਹੀ ਇੱਕ ਉਦਾਹਰਣ ਹੈ ਅਨਮੋਲ ਕਵਾਤਰਾ ਜੋ ਕਿ ਪੰਜਾਬ ਦਾ ਹੀ ਵਾਸਵਿਕ ਹੈ ਉਹ ਹੁਣ ਵਿਦੇਸ਼ ਤੋਂ ਵਾਪਿਸ ਪੰਜਾਬ ਆ ਗਿਆ ਹੈ ਉਹ ਲੋਕਾਂ ਦੀ ਬਹੁਤ ਸੇਵਾ ਕਰਦਾ ਹੈ ਅਤੇ ਉਸ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਪਾਉਂਦਾ ਰਹਿੰਦਾ ਹੈ ਜੇ ਉਹ ਕਿਸੇ ਦੀ ਸੇਵਾ ਨਹੀਂ ਵੀ ਕਰ ਸਕਦਾ ਤਾਂ ਉਹ ਫੋਟੋ ਪਾਉਂਦਾ ਹੈ ਜਿਸ ਨਾਲ ਹੋਰ ਲੋਕ ਜੋ ਕਰ ਸਕਦੇ ਹਨ ਉਹ ਉਸ ਦੀ ਮਦਦ ਕਰਦੇ ਹਨ ਇਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਨਾਲ ਨਾਲ ਲੋਕਾਂ ਨੂੰ ਅਸੀਂ ਚੰਗੇ ਅਤੇ ਮਾੜੇ ਕੰਮਾਂ ਬਾਰੇ ਦੱਸਦੇ ਹਨ ਅਤੇ ਲੋਕਾਂ ਨੂੰ ਪ੍ਰੇਰਣਾ ਦਿੰਦੇ ਹਨ ਕਿ ਉਹ ਵੀ ਚੰਗੇ ਕੰਮ ਕਰੇ ਜੇ ਕੋਈ ਵੀ ਕੰਮ ਕਰਦਾ ਹੈ ਜੇ ਉਹ ਫੋਟੋ ਪਾਉਂਦਾ ਹੈ ਚਾਹੇ ਉਹ ਇਸ ਲਾਲਚ ਵਿੱਚ ਪਾਉਂਦਾ ਕਿ ਉਸਨੂੰ ਫੇਮ ਮਿਲੇਗੀ ਜਾਂ ਉਸਦੀ ਪ੍ਰਸਿੱਧੀ ਹੋਵੇਗੀ ਤਾਂ ਵੀ ਉਹ ਠੀਕ ਹੈ ਕਿਉਂਕਿ ਉਹ ਕਿਸੇ ਦੀ ਸੇਵਾ ਕਰ ਰਿਹਾ ਹੈ ਇਸ ਤਰ੍ਹਾਂ ਅਸੀਂ ਹੋਰ ਵੀ ਕਈ ਕੰਮ ਸੋਸ਼ਲ ਮੀਡੀਆ ਰਾਹੀਂ ਕਰ ਸਕਦੇ ਹਨ ਕਿਸੇ ਦੇ ਨਾਲ ਕੋਈ ਅਪਰਾਧ ਹੋਇਆ ਹੈ ਉਸ ਨੂੰ ਲੋਕਾਂ ਤੱਕ ਪਹੁੰਚਾ ਸਕਦੇ ਹਨ ਜੇ ਕੋਈ ਵੀ ਉਸਦੀ ਖਿਲਾਫ਼ ਆਵਾਜ਼ ਨਹੀਂ ਉਠਾਉਂਦਾ ਤਾਂ ਸੋਸ਼ਲ ਮੀਡੀਆ ਇੱਕ ਬਹੁਤ ਹੀ ਵੱਡਾ ਹਥਿਆਰ ਵੀ ਸਾਬਤ ਹੁੰਦਾ ਹੈ ਕਿਉਂਕਿ ਜੋ ਲੋਕ ਸੋਸ਼ਲ ਮੀਡੀਆ 'ਤੇ ਵੇਖਦੇ ਹਨ ਉਸ ਦੇ ਖਿਲਾਫ਼ ਆਵਾਜ਼ ਜ਼ਰੂਰ ਉਠਾਉਂਦੇ ਹਨ ਕਿਉਂਕਿ ਸੋਸ਼ਲ ਮੀਡੀਆ ਅੱਜ ਕੱਲ੍ਹ ਬਹੁਤ ਲੋਕ ਇਸਤੇਮਾਲ ਕਰ ਰਹੇ ਹਨ ਅਤੇ ਇਹ ਇੱਕਦਮ ਹੀ ਵਾਇਰਲ ਕਰ ਦਿੰਦਾ ਹੈ ਧੰਨਵਾਦ